ਭਾਰਤ ਵਿੱਚ ਮੌਸਮ ਬਹੁਤ ਸੁਹਾਵਣਾ ਹੁੰਦਾ ਹੈ ਸਾਡੇ ਭਾਰਤ ਵਿੱਚ ਜੇ ਅਸੀਂ ਆਪਣੇ ਭਾਰਤ ਦੀ ਗੱਲ ਕਰੀਏ ਤਾਂ ਐਸੇ ਇੱਥੇ ਮੌਸਮ ਸਮੇਂ ਦੇ ਹਿਸਾਬ ਨਾਲ ਬਦਲਦਾ ਰਹਿੰਦਾ ਹੈ ਜੇ ਗਰਮੀਆਂ ਦੇ ਮੌਸਮ ਵਿੱਚ ਗਰਮੀ ਪੈਂਦੀ ਹੈ ਅਤੇ ਸਰਦੀਆਂ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਅਤੇ ਜੇ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ ਇੱਥੇ ਜਗ੍ਹਾ ਦੇ ਹਿਸਾਬ ਨਾਲ ਵੀ ਬਹੁਤ ਫਰਕ ਪੈ ਜਾਂਦਾ ਹੈ ਜੇ ਕਿਤੇ ਠੰਡ ਹੁੰਦੀ ਹੈ ਤਾਂ ਕਿਤੇ ਗਰਮੀ ਹੁੰਦੀ ਹੈ ਅਤੇ ਕਈ ਜਗ੍ਹਾ ਪਰ ਬਰਫ ਵੀ ਪੈਂਦੀ ਹੈ ਅਤੇ ਗਰਮੀਆਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਧੁੱਪ ਹੁੰਦੀ ਹੈ ਅਤੇ ਸੇਕ ਵੀ ਵੱਜਦੀ ਹੈ ਇੰਨੀ ਗਰਮੀ ਹੁੰਦੀ ਹੈ ਕਿ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣਾ ਵੀ ਔਖਾ ਹੋ ਜਾਂਦਾ ਹੈ ਗਰਮੀਆਂ ਦੇ ਮੌਸਮ ਵਿੱਚ ਅਤੇ ਸਰਦੀਆਂ ਦੇ ਮੌਸਮ ਵਿੱਚ ਬਹੁਤ ਠੰਡ ਹੁੰਦੀ ਹੈ ਅਤੇ ਅਸੀਂ ਗੱਲ ਕਰੀਏ ਜੇ